ਸਤਿ ਸ਼੍ਰੀ ਅਕਾਲ ਜੀ ਅਸੀਂ ਐਮਾਜ਼ੋਨ ਤੋਂ ਚੇਅਰਸ ਮੰਗਵਾਈਆਂ ਸੀ ਤਾਂ ਚੇਅਰਸ ਬਹੁਤ ਹੀ ਵਧੀਆ ਨਿਕਲੀਆਂ ਅਤੇ ਉਸਦਾ ਕਲਰ ਵੀ ਬਹੁਤ ਵਧੀਆ ਜਿਸ ਟਾਈਪ ਅਸੀਂ ਦੇਖਿਆ ਸੀ ਉਸ ਟਾਈਪ ਦਾ ਇਹ ਨਿਕਲਿਆ ਅਤੇ ਚੇਅਰਸ ਵੇਖਣ 'ਚ ਵੀ ਬਹੁਤ ਵਧੀਆ ਬਟ ਉਂਝ ਇਹਦਾ ਨਾਮ ਕੀ ਆ ਵੀ ਬਹੁਤ ਹੀ ਜ਼ਿਆਦਾ ਵਧੀਆ ਹੈਗੀਆਂ ਇਹ ਅਤੇ ਕਲਰ ਵੀ ਬਹੁਤ ਵਧੀਆ ਇਹਨਾਂ ਦਾ ਅਤੇ ਵੀ ਮਤਲਬ ਜਿਵੇਂ ਅਸੀਂ ਫਸਟ ਟਾਈਮ ਔਡਰ ਕੀਤਾ ਸੀ ਤਾਂ ਉਸ ਟਾਈਪ ਨਾਲ ਇਹ ਬਹੁਤ ਵਧੀਆ ਨਿਕਲੀਆਂ ਅਤੇ ਮਤਲਬ ਕਿ ਇਹ ਟਾਈਮ ਬਹੁ ਵੀ ਟਾਈਮ ਤੋਂ ਪਹਿਲਾਂ ਹੀ ਆ ਗਿਆ ਇੱਕ ਦੋ ਦਿਨਾਂ ਦੇ ਵਿੱਚ ਹੀ ਆ ਗਿਆ ਜਿਵੇਂ ਅਸੀਂ ਔਡਰ ਕੀਤਾ ਸੀ ਅਤੇ ਇਹ ਸਾਨੂੰ ਬਹੁਤ ਹੀ ਵਧੀਆ ਲੱਗੀਆਂ ਅਤੇ ਵੈਸੇ ਵੀ ਇਹ ਹਾਰਡ ਆ ਅਤੇ ਬਹੁਤ ਵਧੀਆ ਹੈਗੀਆਂ ਅਤੇ ਕਲਰ ਵੀ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਹੈਗਾ ਸਾਨੂੰ ਬਹੁਤ ਪਸੰਦ ਆਈਆਂ ਇਹ ਹਾਂਜੀ